ਹੈਲੋ ਹਾਂਜੀ ਹਾਂਜੀ ਅੱਜ ਕੱਲ ਤਾਂ ਸਾਰਿਆਂ ਹਾਂਜੀ ਅੱਜ ਕੱਲ ਤਾਂ ਸਾਰੇ ਹੀ ਫੋਨ ਵਧੀਆ ਨੇ ਫੇਰ ਵੀ ਤੁਸੀਂ ਦੱਸੋ ਕਿਹੜਾ ਕੰਪਨੀ ਦਾ ਦਿਖਾਈਏ ਤੁਹਾਨੂੰ ਅੱਛਾ ਜੀ ਆਈਫੋਨ ਅੱਛਾ ਅੱਛਾ ਜੀ ਆਈਫੋਨ ਦੇਖ ਲਓ ਫਿਰ ਉਹ ਉਹਨਾਂ ਦੇ ਸੈਟ ਸਾਰੇ ਵਧੀਆ ਹੁੰਦੇ ਨੇ ਆਪਣੇ ਕੋਲ ਸਾਰੇ ਸੈੱਟ ਪਏ ਨੇ ਆਈਫੋਨ ਅੱਛਾ ਜੀ ਅੱਛਾ ਜੀ ਫਿਰ ਰੈਡਮੀ ਦਾ ਦੇਖ ਲਿਓ ਆਪਣੇ ਕੋਲ ਦੋ ਸੈੱਟ ਪਏ ਨੇ ਰੈਡਮੀ ਦੇ ਇੱਕ ਰੈਡਮੀ ਟਵੈਲਵ ਇੱਕ ਥਰਟੀਨ ਇਹ ਦੋਵੇਂ ਫਾਈਵ ਜੀ ਸੈਟ ਨੇ ਹਾਂਜੀ ਅੱਛਾ ਅੱਛਾ ਹਾਂਜੀ ਬਸ ਉਵੇਂ ਦਾ ਹੀ ਹੋਏਗਾ ਥੋੜ੍ਹੇ ਬਹੁਤ ਫੀਚਰ ਚੇਂਜ ਹੋਣਗੇ ਬਸ ਥੋੜ੍ਹੇ ਬਹੁਤ ਜ਼ਿਆਦਾ ਨਹੀਂ ਉਵੇਂ ਦੀ ਹੋਏ ਹਾਂਜੀ ਦੋਵੇਂ ਫਾਈਵ ਡੀ ਦੋਵੇਂ ਫਾਈਵ ਜੀ ਸੈਟ ਨੇ ਦੋਵਾਂ 'ਚ ਇੰਟਰਨੈਟ ਵਧੀਆ ਚੱਲੇਗਾ ਅਤੇ ਵੀਡੀਓ ਕੌਲ ਵੀ ਜਿਵੇਂ ਤੁਸੀਂ ਕਹਿੰਦੇ ਵੀਡੀਓ ਕੌਲ ਕਰਨੀ ਹੈ ਉਹਦਾ ਕੈਮਰਾ ਵੀ ਵਧੀਆ ਵੀਡੀਓ ਕੌਲ ਵੀ ਸਹੀ ਹੋ ਜੇ ਕਰੇਗੀ ਉਹਦੇ 'ਚ ਹਾਂਜੀ ਇਹ ਸਤਾਰਾਂ ਹਜ਼ਾਰ ਦਾ ਪੈ ਜੇਗਾ ਜੀ ਤੁਹਾਨੂੰ ਵਿੱਚੋਂ ਦੋ ਕੁ ਹਜ਼ਾਰ ਡਿਸ ਡਿਸਕਾਊਂਟ ਕਰ ਦਾਂਗੇ ਵਿੱਚੋਂ ਦੋ ਕੁ ਹਜ਼ਾਰ ਹਾਂਜੀ ਹਾਂਜੀ ਜੇ ਤੁਸੀਂ ਕਿਸ਼ਤਾਂ 'ਤੇ ਕਰਵਾਉਣਾ ਫਿਰ ਬਜਾਜ ਕਾਰਡ ਬਣ ਬਣਾ ਦਾਂਗੇ ਤੁਹਾਡਾ ਹਾਂਜੀ ਹਾਂਜੀ ਬਜਾਜ ਕਾਰਡ ਬਣਾ ਦਾਂਗੇ ਉਸ 'ਤੇ ਫਿਰ ਕਿਸ਼ਤਾਂ ਬਣ ਜਾਣਗੀਆਂ ਤੁਹਾਡੀਆਂ ਹਾਂਜੀ ਜੇ ਤੁਹਾਡਾ ਬਜਾਜ ਕਾਰਡ ਬਣਾਉਣਾ ਹੋਇਆ ਆਪਣਾ ਆਧਾਰ ਕਾਰਡ ਪੈਨ ਕਾਰਡ ਨਾਲ ਲੈ ਆਇਓ ਇੱਕ ਬੈਂਕ ਦੀ ਕਾਪੀ ਲੈ ਆਇਓ ਤੁਹਾਡਾ ਕਰੈਡਿਟ ਸਕੋਰ ਦੇਖ ਕੇ ਫਿਰ ਕਰ ਦਾਂਗੇ ਜੀ ਬਣਾ ਦਾਂਗੇ ਉਹ 'ਤੇ ਕਿਸ਼ਤਾਂ ਬਣ ਜਾਣਗੀਆਂ ਬਜਾਜ ਕਾਰਡ 'ਤੇ ਪਹਿਲਾਂ ਬਣਿਆ ਹੋਇਆ ਤੁਹਾਡਾ ਕਿ ਨਹੀਂ ਬਜਾਜ ਕਾਰਡ ਪਹਿਲਾਂ ਬਣਿਆ ਹੋਇਆ ਕੋਈ ਨਹੀਂ ਫਿਰ ਬਣਾ ਦਾਂਗੇ ਜੀ ਉਹ 'ਤੇ ਕਿਸ਼ਤਾਂ ਦੇ ਕਿਸ਼ਤਾਂ ਦੇਖਣਾ ਹੋਇਆ ਦੇਖ ਲਿਓ ਫਿਰ ਨਹੀਂ ਤੇ ਜੇ ਕੈਸ਼ ਲੈਣਾ ਕੈਸ਼ ਦੇਖ ਲਿਓ ਹਾਂਜੀ ਜਿਵੇਂ ਤੁਹਾਨੂੰ ਡਿਸਕਾਊਂਟ ਵੀ ਕਰ ਦਾਂਗੇ ਤੁਹਾਨੂੰ ਕੋਈ ਚੱਕਰ ਨਹੀਂ ਮਾੜਾ ਮੋਟਾ

ਹਾਂਜੀ ਕਿਸ਼ਤਾਂ ਤਾਂ ਤਾਂ ਹੀ ਕਹਿੰਦਾ ਬਜਾਜ ਕਾਰਡ ਤੁਹਾਡਾ ਬਣਾ ਦਾਂਗੇ ਫਿਰ ਉੱਥੇ ਸੌਖਾ ਹਰੇਕ ਤੁਹਾਨੂੰ ਕਿਸ਼ਤਾਂ ਦਾ ਹੋਰ ਵੀ ਅੱਗੇ ਚੀਜ਼ ਲੈਣੀ ਹੋਈ ਉਹ ਵੀ ਤੁਹਾਨੂੰ ਵਧੀਆ ਸਹੀ ਡਿਸਕਾਊਂਟ 'ਤੇ ਮਿਲ ਜਾਵੇਗੀ ਹਾਂਜੀ ਹੋਰ ਵੀ ਮਿਲ ਜਾਣਗੀਆਂ ਜਿਵੇਂ ਕਿ ਲੈਣੀ ਹੋਈ ਫਰਿੱਜ ਕੂਲਰ ਜਾਂ ਕੁਛ ਵੀ ਲੈਣਾ ਹੋਇਆ ਹਾਂਜੀ ਪਰਸੋਂ ਬੰਦ ਜੀ ਕੱਲ ਨੂੰ ਆਜਿਓ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਆਜਿਓ ਹਾਂਜੀ ਕਿਸੇ ਵੀ ਟਾਈਮ ਆ ਜਿਓ ਬਸ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਹਾਂਜੀ ਠੀਕ ਹੈ ਠੀਕ ਹੈ ਅਤੇ ਆਜਿਓ ਜੀ ਕੱਲ ਨੂੰ ਚੰਗਾ ਠੀਕ ਹੈ